ਬਾਈਕਿੰਗ ਕਮਿਊਨਟੀ ਵਿੱਚ ਸ਼ਾਮਿਲ ਹੋਣ ਅਤੇ ਸਵਾਰੀਆਂ ਨੂੰ ਮਿਲਣ ਲਈ ਬਹੁਤ ਵਧੀਆ ਤਰੀਕੇ ਇਹ ਹਨ ਬਹੁਤ ਜ਼ਿਆਦਾ ਹਨ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚੰਗੀ ਡਰਾਈਵਿੰਗ ਆਉਣੀ ਚਾਹੀਦੀ ਆ ਚੰਗੀ ਡਰਾਈਵਿੰਗ ਵਾਲਾ ਬੰਦਾ ਹੀ ਡਰਾਈਵਰ ਮੰਨਿਆਂ ਜਾਂਦਾ ਏ ਅਸੀਂ ਇਕੱਲੇ ਬਾਈਕਿੰਗ ਨੂੰ ਤਰਜੀਹ ਦਿੰਦੇ ਹਾਂ ਕਿਉਂਕਿ ਬਾਈਕ ਰਾਈਡਰ ਬਹੁਤ ਸਾਰੇ ਰਾਈਡ ਕਰਦੇ ਨੇ ਇਕੱਠੇ ਹੋ ਕੇ ਇਹ ਹਫਤੇ ਬਾਅਦ ਜਾਂ ਕੁਛ ਦਿਨਾਂ ਬਾਅਦ ਇਕੱਠੇ ਹੀ ਬਾਈਕ ਰਾਈਡ ਕਰਦੇ ਨੇ ਇਹਨਾਂ ਸਾਰਿਆਂ ਨੇ ਬਾਈਕ ਰਾਈਡਰਾਂ ਨੇ ਜਿੱਥੋਂ ਆਪਣਾ ਸ਼ੁਰੂਆਤ ਕੀਤੀ ਹੁੰਦੀ ਆ ਅਤੇ ਉੱਥੇ ਹੀ ਇਹਨਾਂ ਦੀ ਐਂਡਿੰਗ ਲਾਈਨ ਹੁੰਦੀ ਹੈ ਜਿੱਥੇ ਇਹਨਾਂ ਨੇ ਮਤਲਬ ਆਪਣਾ ਦੁਬਾਰਾ ਵਾਪਸ ਇਕੱਠੇ ਹੋਣਾ ਹੁੰਦਾ ਹੈ ਬਾਈਕ ਰਾਈਡਰ ਦੇ ਵਧੀਆ ਤਰੀਕੇ ਬਾਕੀ ਸਭ ਤੋਂ ਬੈਸਟ ਇਹੀ ਆ ਵੀ ਸਿਰ ਨੂੰ ਹੈਲਮਟ ਲਾ ਕੇ ਰੱਖਣਾ ਜੋ ਇਹਨਾਂ ਨੂੰ ਸੇਫ ਰੱਖਦਾ ਏ ਅਤੇ ਬਾਹਾਂ ਅਤੇ ਲੱਤਾਂ 'ਤੇ ਕੱਪ ਚੜ੍ਹਾਉਣੇ ਆਦਿ ਹੋਰ ਕਈ ਚੀਜ਼ਾਂ ਇਹੋ ਜਿਹੀਆਂ ਹਨ